ਹੈਲੋ ਬਿਜਲੀ ਬੋਰਡ ਮੇਰਾ ਨਾਮ ਨਵੀਨ ਹੈ ਮੈਂ ਪਟੇਲ ਨਗਰ ਗਲੀ ਨੰਬਰ ਛੇ ਵਿੱਚ ਵਾਰਡ ਨੰਬਰ ਪੱਚੀ ਮਕਾਨ ਨੰਬਰ ਅਠਵੰਜਾ ਵਿੱਚ ਰਹਿੰਦਾ ਹਾਂ ਮੇਰਾ ਇੱਕ ਮਕਾਨ ਗਲੀ ਨੰਬਰ ਸੱਤ ਵਿੱਚ ਨਵਾਰਡ ਨੰਬਰ ਪੱਚੀ ਅਤੇ ਮਕਾਨ ਨੰਬਰ ਸਤਵੰਜਾ ਹੈਗਾ ਹੈ ਉਸ ਵਿੱਚ ਮੈਂ ਆਪਣੇ ਕਿਰਾਏਦਾਰ ਬਿਠਾਏ ਹੋਏ ਹਨ ਉਹ ਕਿਰਾਏਦਾਰ ਦੁਆਰਾ ਬਿਜਲੀ ਦੀ ਵਰਤੋਂ ਵੱਧ ਮਾਤਰਾ ਵਿੱਚ ਕੀਤੀ ਜਾਂਦੀ ਹੈ ਅਤੇ ਮਕਾਨ ਦੇ ਵਿੱਚ ਰਹਿਣ ਵਾਲੇ ਕਿਰਾਏਦਾਰ ਬਿਜਲੀ ਦਾ ਬਿੱਲ ਸਹੀ ਢੰਗ ਨਾਲ ਨਹੀਂ ਭਰ ਰਹੇ ਮੈਨੂੰ ਫਰਜ਼ੀ ਬਿੱਲ ਦਿਖਾ ਰਹੇ ਹਨ ਮੈਨੂੰ ਕੱਲ੍ਹ ਬਿਜਲੀ ਬੋਰਡ ਤੋਂ ਫੋਨ ਆਇਆ ਹੈ ਕਿ ਉਹ ਬਿਜਲੀ ਦਾ ਬਿੱਲ ਨਹੀਂ ਭਰ ਰਹੇ ਹਨ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੁਬਾਰਾ ਦੱਸਿਆ ਗਿਆ ਕਿ ਬਿਜਲੀ ਦਾ ਬਿੱਲ ਭਰ ਦਿੱਤਾ ਗਿਆ ਹੈ ਪਰ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਉਹਨਾਂ ਨੇ ਮੈਨੂੰ ਫਰਜ਼ੀ ਬਿੱਲ ਦਿਖਾ ਦਿੱਤਾ ਹੈ ਪਰ ਬਿਜਲੀ ਦੁਆ ਬੋਰਡ ਦੁਆਰਾ ਆਇਆ ਫੋਨ ਵਿੱਚ ਰੀਡਿੰਗ ਦਿਖਾਈ ਗਈ ਹੈ ਕਿ ਉਹਨਾਂ ਨੇ ਬਿੱਲ ਨਹੀਂ ਭਰਿਆ ਗਿਆ ਹੈ ਕਿਰਪਾ ਕਰਕੇ ਤੁਸੀਂ ਦੀ ਮੈਨੂੰ ਦੱਸੋ ਕਿ ਇਹ ਬਿੱਲ ਭਰਿਆ ਹੋਇਆ ਜਾਂ ਨਹੀਂ ਜਾਂ ਇਸਦੀ ਜਾਣਕਾਰੀ ਦਿਓ ਦੁਬਾਰਾ ਬਿਜਲੀ ਦੇ ਮੀਟਰ ਦੀ ਰੀਡਿੰਗ ਕੱਢੋ ਇਹ ਬਿੱਲ ਮੇਰੇ ਨਾਮ 'ਤੇ ਹੈ ਇਸ ਕਰਕੇ ਮੈਨੂੰ ਬਿਜਲੀ ਬੋਰਡ ਤੋਂ ਫੋਨ ਆਇਆ ਹੈ ਕਿਰਪਾ ਕਰਕੇ ਇਸ ਦੀ ਜਾਣਕਾਰੀ ਦਿਓ ਅਤੇ ਸਹੀ ਬਿੱਲ ਬਾਰੇ ਮੈਨੂੰ ਜਾਂ ਦੱਸੋ ਬਿਜਲੀ ਬਿੱਲ ਅੱਗੇ ਤੋਂ ਮੈਨੂੰ ਮੇਰੇ ਵਟਸਅੱਪ ਨੰਬਰ ਉੱਤੇ ਭੇਜ ਕੇ ਮੇਰੀ ਕਿਰ ਮਦਦ ਕਰੋ ਤਾਂ ਕਿ ਮੈਂ ਸਹੀ ਬਿੱਲ ਭਰ ਸਕਾਂ ਅਤੇ ਸਹੀ ਅਮਾਊਂਟ ਦਾ ਪਤਾ ਲੱਗ ਸਕੇ ਕਿਰਾਏਦਾਰ ਬਹੁਤ ਝੂਠ ਬੋਲ ਕੇ ਫਰਜ਼ੀ ਬਿੱਲ ਦਿਖਾ ਕੇ ਝੂਠ ਬੋਲ ਰਹੇ ਹਨ ਕਿ ਉਹਨਾਂ ਨੇ ਫਰਜ਼ੀ ਬਿੱਲ ਦਿੱਤਾ ਹੈ ਅੱਗੇ ਤੋਂ ਜੇਕਰ ਕੋਈ ਫਰਜ਼ੀ ਬਿੱਲ ਉਹ ਦਿਖਾਉਂਦੇ ਹਾਂ ਅਤੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਇਹ ਕਿਰਾਏਦਾਰ ਜ਼ਿੰਮੇਵਾਰ ਹੋਣਗੇ ਮੈਨੂੰ ਸਹੀ ਰੀਡਿੰਗ ਦੇਖ ਕੇ ਮੇਰੀ ਮਦਦ ਕਰੋ